ਹੈਲੋ ਕਨਿਸ਼ਕਾ ਬੋਲ ਰਹੇ ਹੋ ਤੁਸੀਂ ਮੇਰੀ ਫਰੇਂਡ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਜੀ ਐਕਚੁਲੀ ਮੈਂ ਮਾਨਸਾ ਆਈ ਸੀ ਮੈਂ ਫੂਡ ਵਲੋਗਿੰਗ ਕਰਦੀ ਹਾਂ ਮੈਨੂੰ ਵਲੋਗ ਬਣਾਉਣਾ ਸੀ ਫੂਡ ਰਿਲੇਟਡ ਅਤੇ ਤੁਸੀਂ ਮਤਲਬ ਜਾਂਦੇ ਰਹਿੰਦੇ ਹੋ ਜੀ ਆਪਣੀ ਫੈਮਲੀ ਨਾਲ

ਅੱਛਾ ਜੀ ਫਿਰ ਕੋਈ ਹੈਗਾ ਫਾਸਟ ਫੂਡ ਦਾ ਜੀ ਵਧੀਆ ਸੈਂਟਰ ਜੀ

ਅੱਛਾ ਜੀ ਠੀਕ ਹੈ ਜੀ ਅਤੇ ਹਾਈਜੀਨ ਵਗੈਰਾ ਵਧੀਆ ਹੁੰਦੀ ਆ ਸਾਫ਼ ਸਫ਼ਾਈ ਵਧੀਆ ਹੁੰਦੀ ਆ ਉੱਥੇ ਜੀ ਅਤੇ ਜੀ ਰੇਟ ਵਗੈਰਾ ਵਧੀਆ ਨੇ ਜੀ ਸਭ ਇਹਨਾਂ ਦੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਮੇਰਾ ਨਾ ਯੂਟਿਊਬ ਚੈਨਲ ਹੈਗਾ ਮੈਨੇ ਨਾ ਅਸਲ 'ਚ ਵਲੋਗ ਬਣਾਉਣਾ ਸੀ ਤਾਂ ਉਹ ਵੀਡੀਓ ਅਲਾਓ ਕਰ ਦੇਣਗੇ ਅਸੀਂ ਵੀਡੀਓ ਬਣਾ ਸਕਦੇ ਹੈਗੇ ਅੱਛਾ ਜੀ ਠੀਕ ਹੈ ਜੀ ਮਤਲਬ ਆਪਾਂ ਵੀਡੀਓ ਈਜ਼ੀਲੀ ਬਣਾ ਸਕਦੇ ਹਾਂ ਮਤਲਬ ਅਲਾਓ ਕਰ ਦੇਣਗੇ ਠੀਕ ਹੈ ਜੀ ਥੈਂਕ ਯੂ